ਹਾਂ ਮੇਰੇ ਪਿੰਡ ਦੇ ਨੌਜਵਾਨਾਂ ਨੇ ਹਾਲ ਦੇ ਹੀ ਸਾਲਾਂ ਵਿੱਚ ਕੁਝ ਸਾਲਾਂ ਤੋਂ ਦਿਲਚਸਪੀ ਲੈ ਰਹੇ ਹਨ ਹਰ ਪਾਸੇ ਹੁਣ ਦਿਲਚਸਪੀ ਵੱਧ ਗਈ ਹੈ ਪਹਿਲਾਂ ਲੋਕ ਜ਼ਿਆਦਤਰ ਪੁਰਾਣੇ ਸਮੇਂ ਦੇ ਵਿੱਚ ਪ੍ਰੋਗਰਾਮਾਂ 'ਤੇ ਪੰਜਾਬੀ ਫੋਕ ਡਾਂਸ ਹੀ ਕਰਦੇ ਸਨ ਪਰ ਹੁਣ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਪੰਜਾਬੀ ਫੋਂਕ ਡਾਂਸ ਦੇ ਨਾਲ ਨਾਲ ਲੋਕ ਅੱਜ ਦੇ ਡਾਂਸ ਆਧੁਨਿਕ ਡਾਂਸ ਵੀ ਮੈਂ ਕਰ ਰਹੇ ਹਨ ਜਿਵੇਂ ਕਿ ਹਿਪ ਹੋਪ ਬੋਲੀਵੁੱਡ ਡਾਂਸ ਸਟਾਈਲ ਅਤੇ ਸਮਾਂ ਜੋ ਕਿ ਸਮਾਜਿਕ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਡਾਂਸ ਵਾਇਰਲ ਡਾਂਸ ਵੀਡੀਓ ਵੀ ਹੀ ਕਰਦੇ ਹਨ ਅਤੇ ਇਸ ਨਾਲ ਇਹ ਬਹੁਤ ਫਰਕ ਪਿਆ ਹੈ ਪਹਿਲਾਂ ਨਾਲੋਂ ਇਹ ਆਮ ਅੱਜ ਕੱਲ੍ਹ ਦੇ ਲੋਕਾਂ ਦੇ ਨੌਜਵਾਨਾਂ ਵਿੱਚ ਜ਼ਿਆਦਾ ਵੇਖਿਆ ਜਾ ਰਿਹਾ ਹੈ ਜਿਸ ਜਿੱਥੇ ਨੌਜਵਾਨ ਆਪਣੀ ਕਲਾ ਵੀ ਦਿਖਾਉਂਦੇ ਹਨ ਅਤੇ ਆਪਣੀ ਮੀਡੀਆ ਪਲੇਟਫੋਰਮ 'ਤੇ ਵੀਡੀਓ ਬਣਾ ਕੇ ਲੋਕਾਂ ਵਿੱਚ ਸ਼ੇਅਰ ਕਰਦੇ ਹਨ ਅਤੇ ਆਪਣਾ ਇੰਟਰਟੇਨਮੈਂਟ ਕਰਦੇ ਹਨ ਅਤੇ ਲੋਕਾਂ ਦਾ ਇੰਟਰਟੇਨਮੈਂਟ ਕਰਦੇ ਹਨ ਅਤੇ ਇਸ ਦੇ ਨਾਲ ਮੁਕਾਬਲੇਬਾਜ਼ੀ ਵੀ ਵਧੀ ਹੈ ਲੋਕ ਵੱਧ ਤੋਂ ਵੱਧ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਹਨ ਅਤੇ ਫੇਮਸ ਹੋਣਾ ਚਾਹੁੰਦੇ ਹਨ ਅਤੇ ਉਹ ਇਸ ਦੇ ਲਈ ਨਾਲ ਨਾਲ ਈਵੈਂਟ 'ਤੇ ਵੀ ਜਾਂਦੇ ਹਨ ਦੇਖਦੇ ਹਨ ਅਤੇ ਉੱਥੋਂ ਸਿੱਖਦੇ ਹਨ ਪਿੰਡ ਦੇ ਨੌਜਵਾਨਾਂ ਵਿੱਚ ਇੱਕ ਵਧੀਆ ਮੁਕਾਬਲੇ ਦਾ ਮਾਹੌਲ ਬਣ ਗਿਆ ਜਿੱਥੇ ਹਰ ਕੋਈ ਆਪਣਾ ਵਧੀਆ ਪ੍ਰਦਰਸ਼ਨ ਦੇਣਾ ਚਾਹੁੰਦਾ ਹੈ ਅਤੇ ਆਪਣੇ ਆਪ ਨੂੰ ਵਧੀਆ ਦਿਖਾਉਣਾ ਚਾਹੁੰਦਾ ਹੈ ਦੂਸਰਿਆਂ ਨਾਲੋਂ ਇਹਦੀ ਮੁਕਾਬਲੇ ਦੀ ਸਥਿਤੀ ਪੈਦਾ ਹੋ ਗਈ ਹੈ ਜਿਸ ਨਾਲ ਹਰ ਇੱਕ ਵਿੱਚ ਆਤਮ ਵਿਸ਼ਵਾਸ ਵੀ ਵਧ ਗਿਆ ਹੈ ਅਤੇ ਮੁਕਾਬਲੇ ਦਾ ਮਾਹੌਲ ਬਣ ਗਿਆ ਹਰ ਕੋਈ ਆਪਣੇ ਆਪ ਲਈ ਵਧੀਆ ਪ੍ਰਦਰਸ਼ਨ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦਿੰਦੇ ਵੀ ਹਨ ਜਿਸ ਨਾਲ ਵਧੀਆ ਪ੍ਰਦਰਸ਼ਨ ਹੁੰਦਾ ਹੈ ਅਤੇ ਲੋਕਾਂ ਵਿੱਚ ਉਹ ਰਚਨਦਾਰ ਅਤੇ ਪ੍ਰਦਰਸ਼ਨਦਾਰ ਬਣ ਗਏ ਹਨ ਅਤੇ ਜਿਸ ਨਾਲ ਲੋਕਾਂ ਦੀ ਵਿੱਚ ਤੰਦਰੁਸਤੀ ਅਤੇ ਆਤਮ ਵਿਸ਼ਵਾਸ ਅਤੇ ਸਕਾਰਾਤਮਕ ਪ੍ਰਭਾਵ ਵੀ ਪੈਦਾ ਹੁੰਦੇ ਹਨ ਅਤੇ ਉਹਨਾਂ ਦੇ ਸਕਾਰਾਤਮਕ ਅਤੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ ਜੇ ਜਿਸ ਦੇ ਨਾਲ ਇੱਕ ਦੂਸਰੇ ਦੇ ਨਾਲ ਉਹ ਹੱਕ ਵਿੱਚ ਵੀ ਖੜ੍ਹਦੇ ਹਨ ਜਿਸ ਨਾਲ ਮੇਰੇ ਪਿੰਡ ਦੇ ਨੌਜਵਾਨਾਂ ਦੀ ਦਿਲਚਸਪੀ ਵੱਧ ਗਈ ਹੈ ਅਤੇ ਉਹ ਆਪਣੇ ਟਰੈਂਡ ਵਿੱਚ ਚੱਲ ਰਹੇ ਹਨ ਇਸ ਦੇ ਨਾਲ ਹੀ ਉਹ ਕਲਚਰ ਨੂੰ ਵੀ ਪ੍ਰਮੋਟ ਕਰ ਰਹੇ ਹਨ ਜਿਸ ਨਾਲ ਸਾਡੀ ਪੰਜਾਬੀ ਵਿਰਾਸਤ ਵੀ ਜਿੰਦਾ ਰਹੇਗੀ